ਭੰਗੜਾ ਸਾਡੇ ਲਈ ਇਸ ਕਰਕੇ ਜ਼ਿਆਦਾ ਜ਼ਰੂਰੀ ਹੈ ਪਹਿਲੀ ਗੱਲ ਤਾਂ ਇਹ ਸਾਡਾ ਇੱਕ ਵਿਰਸਾ ਹੈ ਇਹ ਵਿਰਸਾ ਜਿਹੜਾ ਪੰਜਾਬ ਨੂੰ ਦਰਸਾਉਂਦਾ ਅਤੇ ਇਹ ਸਾਡੇ ਲਈ ਹਰ ਖੁਸ਼ੀ ਦੇ ਮੌਕੇ 'ਤੇ ਕੋਈ ਵੀ ਜਿਵੇਂ ਕਿਸਾਨ ਸਾਡੇ ਦੇਸ਼ ਦੇ ਕਿਸਾਨ ਨੇ ਜਦੋਂ ਫ਼ਸਲਾਂ ਪੱਕ ਜਾਂਦੀਆਂ ਮੋਸਟਲੀ ਅਪ੍ਰੈਲ ਦੇ ਮਹੀਨੇ ਜਦੋਂ ਫ਼ਸਲ ਸਾਡੀ ਪੱਕ ਜਾਂਦੀ ਹੈ ਕਣਕ ਦੀ ਅਤੇ ਉਹਦੀ ਵਾਢੀ ਕਰਨ ਲਈ ਜਾਂਦੇ ਹੈ ਤਾਂ ਉਦੋਂ ਵਾਢੀ ਕਰਕੇ ਫ਼ਸਲ ਨੂੰ ਵੇਚਦੇ ਹੈ ਫਿਰ ਖੁਸ਼ੀ 'ਚ ਭੰਗੜਾ ਪਾਉਂਦੇ ਨੇ ਜਦੋਂ ਫ਼ਸਲਾਂ ਪੱਕ ਜਾਂਦੀਆਂ ਉਹਨਾਂ ਦੀਆਂ ਅਤੇ ਜਾਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਕਿਸੇ ਬੱਚੇ ਦਾ ਜਨਮ ਹੁੰਦਾ ਉਦੋਂ ਸਾਡੇ ਲਈ ਭੰਗੜਾ ਬਹੁਤ ਹੀ ਮੁੱਖ ਹੈ ਅਤੇ ਹੋਰ ਇਹਦੇ ਨਾਲ ਸਾਡੀ ਜਿਹੜੀ ਸਰੀਰਿਕ ਐਕਟੀਵਿਟੀ ਬਹੁਤ ਹੋ ਜਾਂਦੀ ਹੈ ਭੰਗੜਾ ਸਾਡੇ ਲਈ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਵੀ ਹੈ ਇਹਦੇ ਨਾਲ ਸਾਡੀਆਂ ਲੱਤਾਂ ਬਾਹਵਾਂ ਗੋਡੇ ਅਤੇ ਸਾਡੀ ਬਾਡੀ ਦੇ ਵਿੱਚ ਇੱਕ ਲਚਕੀਲਾਪਨ ਆ ਜਾਂਦਾ ਹੈ ਤਾਂ ਉਹਦੇ ਕਰਕੇ ਅਸੀਂ ਭੰਗੜਾ ਮਨਾਉਣੇ ਹਾਂ ਇੱਕ ਤਾਂ ਇਹ ਸਾਡੇ ਸਰੀਰ ਨੂੰ ਬਹੁਤ ਐਕਟਿਵ ਰੱਖਦਾ ਹੈ ਮੋਸਟਲੀ ਅਤੇ ਸਾਡਾ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਅਸੀਂ ਇਹਦੇ ਨਾਲ ਭੰਗੜੇ ਨਾਲ ਹਰ ਖੁਸ਼ੀ ਦੇ ਮੌਕੇ 'ਤੇ ਇਹਨੂੰ ਪਾਉਂਦੇ ਹਾਂ ਅਸੀਂ ਭੰਗੜੇ ਨੂੰ ਅਤੇ ਇਹਦੇ ਨਾਲ ਸਾਡਾ ਸਰੀਰ ਬਹੁਤ ਐਕਟਿਵ ਰਹਿੰਦਾ ਮੋਸਟਲੀ ਸਾਡਾ ਵਿਰਸਾ ਹੈ ਪੰਜਾਬ ਦਾ ਭੰਗੜਾ ਇਸ ਕਰਕੇ ਅਸੀਂ ਭੰਗੜੇ ਨੂੰ ਜ਼ਿਆਦਾ ਪਿਆਰ ਕਰਦੇ ਹਾਂ